ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬੋਲੋ ਹਾਂ ਤੁਸੀਂ ਪਹਿਲਾਂ ਵੀ ਇੱਕ ਦੋ ਵਾਰੀ ਕਿਹਾ ਸੈਲਰੀ ਵਧਾਉਣ ਨੂੰ ਪਰ ਪ੍ਰੋਬਲਮ ਇਹ ਹੈ ਤੁਹਾਨੂੰ ਪਤਾ ਇੱਕ ਤਾਂ ਮੇਰੇ ਕੋਲ ਹੁਣ ਸਟਾਫ ਭਾਅ ਜੀ ਕਾਫ਼ੀ ਹੈ ਹੈ ਨਾ ਅਤੇ ਬਿਜਨਸ ਵੀ ਹਜੇ ਤੁਹਾਨੂੰ ਪਤਾ ਹੈ ਨਾ ਥੋੜ੍ਹੇ ਜਿਹੇ ਸਰਕਮਸਟਾਂਸ ਕਿਹੋ ਜਿਹੇ ਨੇ ਅਤੇ ਆਉਣ ਵਾਲੇ ਟੈਮ 'ਚ ਆਪਾਂ ਸੋਚ ਸਕਦੇ ਹਾਂ ਠੀਕ ਹੈ ਹਜੇ ਤੁਸੀਂ ਕੰਮ ਕਰੋ

ਇੰਕਰੀਮੈਂਟ ਕਰ ਲਾਂਗੇ ਚੱਲ ਐਂ ਤਾਂ ਕੋਈ ਗੱਲ ਨਹੀਂ ਤੁਹਾਡਾ ਕੰਮ ਕਾਰ ਬਹੁਤ ਵਧੀਆ ਉਹਨੂੰ ਦੇਖਦੇ ਹੋਏ ਪਰ ਥੋੜ੍ਹਾ ਹਜੇ ਟੈਮ ਲੱਗਣਾ ਹੈ ਥੋ ਥੋੜ੍ਹੀ ਜਿਹੀ ਵੇਟ ਕਰੋ ਹਾਂ ਨਹੀਂ ਇਸ ਤਾ ਤਾਹੀਂਓ ਤਾਂ ਕਹਿੰਦੇ ਨਾ ਤਾਹੀਂਓ ਤਾਂ ਤੁਹਾਨੂੰ ਰੱਖਿਆ ਹੋਇਆ ਤੁਸੀਂ ਮਿਹਨਤ ਕਰਦੇ ਇਸੇ ਕਰਕੇ ਅਤੇ ਠੀਕ ਹੈ ਚਲੋ ਕੋਈ ਗੱਲ ਨਹੀਂ ਹੈ ਨਾ ਓਕੇ ਬਾਏ ਠੀਕ ਠੀਕ